ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਿੱਟੀ ਦੀ ਕਲਾ ਲਈ ਮੂਲ ਸਮਗਰੀ ਦੀ ਚੋਣ ਕੀਤੀ ਜਾਂਦੀ ਹੈ ਇਹ ਮੂਲ ਸਮਗਰੀ ਜਿਵੇਂ ਕਿ ਬਲੇਡ ਸੈਟ ਕਰਾਫਟ ਨਾਈਫ ਪਲੇਇੰਗ ਕਾਰਡਸ ਇੱਕ ਡਰੈੱਲ ਹੋਲ ਕਰਨ ਲਈ ਅਤੇ ਕੁਝ ਆਰਟੀਫਿਸ਼ਲ ਪਲਾਸਟਿਕ ਸ਼ੇਪ ਟੈਮਪਲੈਟਸ ਲੈਂਦੇ ਹਾਂ ਅਸੀਂ ਇਹਨਾਂ ਦੀ ਚੋਣ ਮਿੱਟੀ ਦੀ ਕੋਈ ਚੀਜ਼ ਬਣਾਉਣ ਸਮੇਂ ਹੀ ਕਰਦੇ ਹਾਂ ਅਸੀਂ ਕੀ ਐਟਮ ਬਣਾਉਣੀ ਹੈ ਵੈਸੇ ਤਾਂ ਕਲਰਫੁਲ ਮਿੱਟੀ ਵੀ ਬਾਜ਼ਾਰ ਵਿੱਚੋਂ ਮਿਲ ਜਾਂਦੀ ਹੈ ਜਿਸ ਨੂੰ ਕਲੇ ਕਿਹਾ ਜਾਂਦਾ ਹੈ ਪਰ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਦੀ ਟਕਨੀਕ ਨਹੀਂ ਸੀ ਤਾਂ ਉਹ ਫੂਡ ਕਲਰ ਵਰਤਦੇ ਸਨ ਜਿਵੇਂ ਕਿ ਇਗਜਾਮਪਲ ਦੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਮਿੱਟੀ ਦਾ ਘੜਾ ਬਣਾਇਆ ਜਾਂਦਾ ਸੀ ਤਾਂ ਕੱਚੇ ਘੜੇ ਨੂੰ ਸੁਕਾ ਕੇ ਅੱਗ ਵਿੱਚ ਪਾਇਆ ਜਾਂਦਾ ਸੀ ਤਾਂ ਫਿਰ ਉਸ ਨੂੰ ਕਲਰ ਕਰ ਦਿੱਤਾ ਜਾਂਦਾ ਸੀ ਪਰ ਹੁਣ ਕਲਰਫੁਲ ਮਿੱਟੀ ਮਿਲ ਜਾਂਦੀ ਹੈ ਜਿਸ ਵਿੱਚ ਅਸੀਂ ਟੈਕਸਚਰਾਂ ਨੂੰ ਵੀ ਸ਼ਾਮਿਲ ਕਰ ਸਕਦੇ ਹਾਂ ਕਿਉਂਕਿ ਇਹ ਕਲੇ ਸੋਲਿਉਬਲ ਹੁੰਦੀ ਹੈ